ਟੈਲੀਵਿਜ਼ਨ ਆਧੁਨਿਕ ਵਿਗਿਆਨ ਦੀ ਇੱਕ ਵਚਿੱਤਰ ਕਾਢ ਹੈ ਇਸ ਵਿੱਚ ਰੇਡੀਉ ਅਤੇ ਸਿਨੇਮਾ ਦੋਹਾਂ ਦੇ ਗੁਣ ਭਰੇ ਹੋਏ ਹਨ ਅੱਜਕੱਲ੍ਹ ਤਾਂ ਸਮਾਰਟ ਟੀ ਵੀਆਂ ਦਾ ਜ਼ਮਾਨਾ ਹੈ ਇਸ ਦਾ ਅਜੌਕੇ ਮਨੋਰੰਜਨ ਦੇ ਸਾਧਨਾਂ ਵਿੱਚ ਆਪਣਾ ਮੌਲਿਕ ਅਤੇ ਖ਼ਾਸ ਸਥਾਨ ਹੈ ਜਿੱਥੇ ਰੇਡੀਉ ਰਾਹੀਂ ਸਾਡੇ ਤੱਕ ਕੇਵਲ ਆਵਾਜ਼ ਰਾਹੀਂ ਵੱਖ ਵੱਖ ਪ੍ਰਕਾਰ ਦੇ ਪ੍ਰੋਗਰਾਮ ਪਹੁੰਚਦੇ ਜਾਂ ਪਹੁੰਚਾਉਂਦੇ ਜਾਂਦੇ ਹਨ ਉੱਥੇ ਟੈਲੀਵਿਜ਼ਨ ਵਿੱਚ ਉਸ ਪ੍ਰੋਗਰਾਮ ਦਾ ਚਿੱਤਰ ਵੀ ਸਾਡੇ ਸਾਹਮਣੇ ਆਉਂਦਾ ਹੈ ਅਤੇ ਮੈਂ ਇਸ ਪ੍ਰਕਾਰ ਟੈਲੀਵਿਜ਼ਨ ਰੇਡੀਉ ਦੇ ਮੁਕਾਬਲੇ ਮਨੋਰੰਜਨ ਜਾਂ ਵਧੇਰੇ ਜਿਉਂਦਾ ਜਾਗਦਾ ਅਤੇ ਪ੍ਰਭਾਵਸ਼ਾਲੀ ਸਾਧਨ ਹੈ ਇਹ ਠੀਕ ਹੈ ਕਿ ਸਿਨੇਮਾ ਵਿੱਚ ਵੀ ਟੈਲੀਵਿਜ਼ਨ ਵਾਂਗ ਆਵਾਜ਼ ਅਤੇ ਤਸਵੀਰ ਦੋ ਦੋਨੋਂ ਹੁੰਦੇ ਹਨ ਪਰ ਸਿਨੇਮਾ ਟੈਲੀਵਿਜ਼ਨ ਦੀ ਜਗ੍ਹਾ ਨਹੀਂ ਲੈ ਸਕਦਾ ਇਸਦਾ ਕਾਰਨ ਹੈ ਇਹ ਹੈ ਕਿ ਸਿਨੇਮਾ ਵਿੱਚ ਕੇਵਲ ਇੱਕ ਫ਼ਿਲਮ ਹੀ ਦਿਖਾਈ ਜਾਂਦੀ ਹੈ ਪਰ ਟੈਲੀਵਿਜ਼ਨ ਵਿੱਚ ਭਾਂਤ ਭਾਂਤ ਦੇ ਪ੍ਰੋਗਰਾਮ ਆਉਂਦੇ ਹਨ ਇਹ ਸਿਰ ਟੈਲੀਵਿਜ਼ਨ ਰਾਹੀਂ ਸਾਨੂੰ ਸਾਰੇ ਦਿਲ ਪ੍ਰਚਾਵਿਆਂ ਦੀ ਘਰ ਬੈਠੇ ਪ੍ਰਾਪਤੀ ਹੁੰਦੀ ਹੈ ਜਦੋਂ ਕਿ ਸਿਨੇਮਾ ਜਾਣ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ